ਸਾਨੂੰ ਪੰਛੀਆਂ ਵਿੱਚੋਂ ਮੋਰ ਸਭ ਤੋਂ ਜਿਆਦਾ ਪਸੰਦ ਬਣਤਰ ਕਰਕੇ ਇਸ ਕਰਕੇ ਆਇਆ ਹੈ ਕਿ ਉਹਦੇ ਵਿੱਚ ਇੱਕ ਤਾਂ ਇਹ ਖਾਸ ਹੈ ਕਿ ਮੋਰ ਆਪਣੇ ਸੁੰਦਰ ਰੂਪ ਲਈ ਪਹਿਚਾਣਿਆ ਜਾਂਦਾ ਹੈ ਤੇ ਉਹ ਜਦੋਂ ਨੱਚਦਾ ਹੈ ਤੇ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਠੀਕ ਐ ਕਹਿੰਦੇ ਹਨ ਕਿ ਮੋਰ ਦੇ ਪੈਰ ਬਹੁਤ ਕਰੂਪ ਹੁੰਦੇ ਹਨ ਪਰ ਮੋਰ ਇੱਕ ਅਜਿਹਾ ਪਕਸ਼ੀ ਹੈ ਕਿ ਜਿਹੜਾ ਤੁਹਾਨੂੰ ਦੂਰ ਦੂਰ ਜੰਗਲਾਂ ਵਿੱਚ ਦਿਖੇਗਾ ਇਥੇ ਤੁਸੀਂ ਤੁਹਾਨੂੰ ਆਮ ਦੇਖਣ ਨੂੰ ਨਹੀਂ ਮਿਲੇਗਾ ਪਰ ਮੈਂ ਜਦੋਂ ਵੀ ਕਦੀ ਮੋਰ ਨੂੰ ਮੀਂਹ ਵਿੱਚ ਇੱਕ ਵਾਰੀ ਅਸੀਂ ਪਹਾੜਾਂ ਤੇ ਘੁੰਮਣ ਗਏ ਪੈਲ ਪਾਂਦੇ ਦੇਖਿਆ ਉਹ ਬਹੁਤ ਹੀ ਜਿਆਦਾ ਪੂਰੇ ਆਪਣੇ ਪੰਖ ਨੂੰ ਫੈਲਾਅ ਕੇ ਇਦਾਂ ਲੱਗ ਰਿਹਾ ਸੀ ਕਿ ਉਹ ਬਹੁਤ ਸੁੰਦਰ ਹੈ ਉਹਦੇ ਰੱਬ ਨੇ ਉਹਨੂੰ ਇੱਕ ਨਿਆਮਤ ਦੇ ਤੌਰ ਤੇ ਖੂਬਸੂਰਤੀ ਦਿੱਤੀ ਹ ਤੇ ਦੇਖੋ ਤੁਸੀਂ ਮੋਰ ਦਾ ਪੰਖ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਤਾਬਾਂ ਵਿੱਚ ਰੱਖੋ ਤੁਹਾਨੂੰ ਪੜ੍ਹਾਈ ਆਏਗੀ ਬੱਚਿਆਂ ਨੂੰ ਤੇ ਨਾਲੇ ਤੁਸੀਂ ਗਣੇਸ਼ ਭਗਵਾਨ ਜੀ ਵੀ ਮੋਰ ਦਾ ਪੰਖ ਲਾ ਕੇ ਘੁੰਮਦੇ ਹਨ ਤੇ ਨਾਲੇ ਆਪਣੇ ਕ੍ਰਿਸ਼ਨ ਭਗਵਾਨ ਜੀ ਵੀ ਲਾਉਂਦੇ ਨੇ ਭਗਵਾਨਾਂ ਦੇ ਰੂਪ ਭਗਵਾਨਾ ਨੂੰ ਵੀ ਚੜਾਇਆ ਜਾਂਦਾ ਹੈ ਪੜ੍ਹਾਈ ਦੇ ਵਿੱਚ ਵੀ ਯੂਜ ਹੁੰਦਾ ਹੈ ਉਦਾਂ ਵੀ ਮੋਰ ਪੰਖ ਤੁਸੀਂ ਆਪਣੇ ਘਰਾਂ ਵਿੱਚ ਵੀ ਮੋਰ ਪੰਖ ਦਾ ਲਗਾ ਕੇ ਰੱਖੋ ਤਾਂ ਕਹਿੰਦੇ ਹਨ ਕਿ ਛਿਪਕਲੀ ਵਗੈਰਾ ਨਹੀਂ ਆਉਂਦੀ ਬਾਕੀ ਮੋਰ ਇੱਕ ਅਜਿਹਾ ਪੰਕਛੀ ਵੈਸੇ ਹੈ ਕੀ ਜਿਹਨੂੰ ਦੇਖ ਕੇ ਮਨ ਪ੍ਰਸੰਨ ਹੋ ਜਾਂਦਾ ਹੈ ਤੇ ਉਹਦੀ ਇੱਕ ਬਨਾਵਟ ਰੂਪ ਰੰਗ ਇਨਾ ਸੁੰਦਰ ਹੈ ਕਿ ਉਹ ਤੁਹਾਨੂੰ ਬਹੁਤ ਸੋਹਣਾ ਲੱਗਦਾ ਇਸ ਕਰਕੇ ਮੈਂ ਵੀ ਮੋਰ ਨੂੰ ਬਹੁਤ ਪਸੰਦ ਕਰਦਾ ਹਾਂ ਦੇ ਮੋਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਧੰਨਵਾਦ